ਮੇਰੇ ਖੇਤਰ ਦੇ ਵਿੱਚ ਮੇਰੇ ਨਾਲ਼ ਦੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆ ਨੇ ਭਾਸ਼ਾਵਾਂ ਬਈ ਕੀ ਬੋਲੀ ਦਾ ਫ਼ਰਕ ਹੈ ਹੈ ਪੰਜਾਬੀ ਉਹ ਪਰ ਉਹਦੇ ਵਿੱਚ ਬੋਲਣ ਦੇ ਜਿਹੜੇ ਵਿਚਾਰ ਨੇ ਜਾਂ ਉਨ੍ਹਾਂ ਦੇ ਸ਼ਬਦ ਨੇ ਉਹ ਅਲੱਗ ਅਲੱਗ ਤਰੀਕੇ ਨਾਲ਼ ਹਰ ਜ਼ਿਲ੍ਹੇ ਦੇ ਵਿੱਚ ਜਿਵੇਂ ਕਿ ਲੁਧਿਆਣਾ ਜ਼ਿਲ੍ਹਾ ਹੋ ਗਿਆ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਹੋ ਗਿਆ ਸੰਗਰੂਰ ਹੋ ਗਿਆ ਪਟਿਆਲਾ ਹੋ ਗਿਆ ਅਤੇ ਬਠਿੰਡਾ ਹੋ ਗਿਆ ਇਨ੍ਹਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਭਾਸ਼ਾ ਬੋਲੀ ਜਾਂਦੀ ਹੈ ਔਰ ਬੋਲਣ ਦੇ ਵਿੱਚ ਜਿਹੜਾ ਨਵਾਂ ਬੰਦਾ ਉਹ ਖੇਤਰ ਦੇ ਵਿੱਚ ਜਾਂਦਾ ਹੈ ਉਹਨੂੰ ਥੋੜ੍ਹੀ ਜਿਹੀ ਔਖੀ ਲੱਗਦੀ ਹੈ ਕਿ ਉਹ ਕੀ ਬੋਲਦਾ ਹੈ ਅਤੇ ਆਮ ਭਾਸ਼ਾ ਜਿਹੜੀ ਹੈ ਇਹ ਟੋਟਲ ਵੈਸੇ ਹੀ ਪੰਜਾਬੀ ਹੈ ਪਰ ਇੱਥੇ ਹੁਣ ਪੰਜਾਬ ਦੇ ਵਿੱਚ ਤਿੰਨ ਕੁ ਤਰ੍ਹਾਂ ਦੀਆਂ ਭਾਸ਼ਾਵਾਂ ਨੇੇ ਜਿਵੇਂ ਕਿ ਖਾਸ ਕਰਕੇ ਤਾਂ ਪੰਜਾਬੀ ਬੋਲੀ ਜਾਂਦੀ ਹੈ ਉਹ ਤੋਂ ਬਾਅਦ ਹਿੰਦੀ ਬੋਲੀ ਜਾਂਦੀ ਹੈ ਹਿੰਦੀ ਤੋਂ ਬਾਅਦ ਕੁਛ ਲੈਂਗੁਏਜ਼ ਇੰਗਲਿਸ਼ ਆ ਗਈ ਹੈ ਜਿਹੜੀ ਕਿ ਉਹ ਸਕੂਲਾਂ ਤੱਕ ਇਹ ਸਕੂਲਾਂ ਦੇ ਪ੍ਰਾਈਵੇਟ ਦੇ ਰੁਝਾਨ ਵੱਧਣ ਕਰਕੇ ਬੱਚਿਆਂ ਨੂੰ ਇੰਗਲਿਸ਼ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਜਿਹਦੇ ਕਰਕੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਘੱਟ ਜਾਂਦੀ ਘੱਟ 'ਤੇ ਇੰਗਲਿਸ਼ ਵੱਲ ਵੱਧ ਪਰ ਇੰਗਲਿਸ਼ ਭਾਸ਼ਾ ਵੱਲ ਜ਼ਿਆਦਾ ਜ਼ੋਰ ਦਿੰਦੇ ਨੇ